ਸਾਡੇ ਘਰ ਜਿੱਦਾਂ ਕਹਿ ਲਓ ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਜਿਹੜੀ ਹੈ ਬਿਜਲੀ ਦੇ ਕੱਟ ਘੱਟ ਹੀ ਲੱਗਦੇ ਹਨ ਬਟ ਕਈ ਵਾਰੀ ਜਿਹੜਾ ਹੈ ਸ ਗਰਮੀਆਂ ਦੇ ਮੌਸਮ 'ਚ ਜਾਂ ਜਦੋਂ ਬਿਜਲੀ ਕੜਕਦੀ ਹੈ ਜਾਂ ਜਦੋਂ ਮੀਂਹ ਆਉਂਦਾ ਹੈ ਓਦੋਂ ਜ਼ਿਆਦਾ ਕੱਟ ਲੱਗਦੇ ਹਨ ਸਰਦੀਆਂ ਵਿੱਚ ਤਾਂ ਕੱਟ ਲੱਗਣ ਨਾ ਲੱਗਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਸਰਦੀਆਂ ਵਿੱਚ ਹੈ ਉਹ ਸਾਨੂੰ ਨਾ ਦੇਖੋ ਜੀ ਫਰਿਜ ਦਾ ਖਾਣਾ ਖਰਾਬ ਹੁੰਦਾ ਹੈ ਨਾ ਹੀ ਸਾਨੂੰ ਕੋਈ ਕਿਸੇ ਏਸੀ ਦੀ ਲੋੜ ਹੁੰਦੀ ਹੈ ਨਾ ਫਰਿਜ ਦੀ ਲੋੜ ਹੁੰਦੀ ਹੈ ਜ਼ਿਆਦਾ ਬਟ ਜਿਹੜੀ ਗਰਮੀਆਂ ਦੇ ਵਿੱਚ ਹੈ ਉਹਦੇ ਵਿੱਚ ਕੱਟ ਵੀ ਜ਼ਿਆਦਾ ਲੱਗਦੇ ਹਨ ਅਤੇ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਵੀ ਜ਼ਿਆਦਾ ਓਸੇ ਟਾਈਮ ਹੀ ਹੁੰਦੀ ਹੈ ਅਸੀਂ ਏਸੀ ਵੀ ਚਲਾਉਣਾ ਹੁੰਦਾ ਅਸੀਂ ਜਿਹੜਾ ਹੈ ਫਰਿਜ ਤੋਂ ਠੰਡਾ ਪਾਣੀ ਵੀ ਪੀਣਾ ਹੁੰਦਾ ਹੈ ਜਿਹੜਾ ਸਮਾਨ ਹੈ ਦੁੱਧ ਹੈ ਫਰੂਟ ਹੈ ਉਹ ਵੀ ਜਿਹੜਾ ਹੈ ਗਰਮੀਆਂ 'ਚ ਬਾਹਰ ਪਿਆ ਪਿਆ ਖਰਾਬ ਹੋ ਜਾਂਦਾ ਹੈ ਸਰਦੀਆਂ ਵਿੱਚ ਇੰਨਾਂ ਨਈਂ ਖਰਾਬ ਹੁੰਦਾ ਬਟ ਜਿਹੜਾ ਗਰਮੀਆਂ ਵਿੱਚ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਇਸ ਕਰਕੇ ਜਿਹੜਾ ਗਰਮੀਆਂ ਵਿੱਚ ਕੱਟ ਲੱਗਦੇ ਹਨ ਉਹ ਸਾਨੂੰ ਬੜੀ ਦਿੱਕਤ ਦਿੰਦੇ ਹਨ ਪਰ ਜਿਹੜੇ ਕੱਟ ਸਰਦੀਆਂ ਵਿੱਚ ਲੱਗਦੇ ਹਨ ਉਹ ਸਾਨੂੰ ਇੰਨੀ ਦਿੱਕਤ ਨਹੀਂ ਦਿੰਦੇ ਮੋਸਟਲੀ ਇੱਦਾਂ ਹੁੰਦਾ ਹੈ ਕਿ ਸਾਨੂੰ ਜਿਹੜੇ ਔਖੇ ਸੌਖੇ ਕੱਟ ਹੁੰਦੇ ਹਨ ਉਹ ਬਾਰਿਸ਼ ਦੇ ਮੌਸਮ 'ਚ ਜਾਂ ਬਿਜਲੀ ਗਿਰਨ ਦੇ ਮੌਸਮ 'ਚ ਹੁੰਦੇ ਹਨ ਉਹ ਕੱਟ ਲੱਗਣੇ ਸਹੀ ਵੀ ਹਨ ਕਿਉਂਕਿ ਉਹਦੇ ਨਾਲ ਸਰਕਿਟ ਸ਼ੋਟ ਸਰਕਿਟ ਹੋ ਸਕਦਾ ਹੈ ਜਾਂ ਕੋਈ ਵੀ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਜਿਹੜਾ ਹੈ ਬਾਰਿਸ਼ ਦੇ ਟਾਈਮ 'ਤੇ ਜਾਂ ਤੂਫਾਨ ਦੇ ਟਾਈਮ 'ਤੇ ਕੱਟ ਲੱਗਣਾ ਬਿਲਕੁਲ ਸਹੀ ਹੈ ਸਰਦੀਆਂ ਵਿੱਚ ਵੀ ਥੋੜ੍ਹੇ ਬਹੁਤ ਕੱਟ ਲੱਗਣੇ ਸਹੀ ਹਨ ਵੈਸੇ ਤਾਂ ਲੱਗਦੇ ਨਹੀਂ ਸਾਡੇ ਇ ਇਲਾਕੇ 'ਚ ਬਟ ਜਿਹੜੇ ਗਰਮੀਆਂ 'ਚ ਕੱਟ ਹਨ ਉਹ ਥੋੜ੍ਹੇ ਬਹੁਤ ਲੱਗ ਜਾਂਦੇ ਹਨ ਮੋਸਟਲੀ ਐਤਵਾਰ ਨੂੰ ਲੱਗਦੇ ਹਨ ਅਤੇ ਉਹ ਨਹੀਂ ਲੱਗਣੇ ਚਾਹੀਦੇ ਕਿਉਂਕਿ ਸਾਨੂੰ ਬੜੀ ਦਿੱਕਤ ਦਿੰਦੇ ਹਨ